ਹਾਈਕਿੰਗ ਕਰਨ ਲਈ ਕਈ ਬੂਟਾਂ ਦੀ ਮਹੱਤਤਾ ਹੈ ਹਾਈਕਿੰਗ ਕਰਨ ਲਈ ਕਿਵੇਂ ਅੱਗੇ ਬੂਟਾਂ ਦੀ ਉਪਲਬਧ ਹੁੰਦੇ ਹਨ ਤੁਸੀਂ ਕਿਹੋ ਜਿਹੇ ਬੂਟਾਂ ਦੀ ਹਾਈਕਿੰਗ ਕਰਨ ਲਈ ਬੂਟਾਂ ਬਹੁਤ ਜ਼ਰੂਰੀ ਹਨ ਅਤੇ ਸਾਨੂੰ ਪੈਰਾਂ ਪੈਰਾਂ ਅਤੇ ਹੱਥ ਸੱਟ ਲੱਗਣਾ ਸੱਟ ਤੋਂ ਬਚਾਉਂਦੇ ਇੱਥੇ ਸਾਨੂੰ ਆਰਾਮਦਾਇਕ ਮਹਿਸੂਸ ਕਰਦੇ ਹਨ ਲਾਈਕ ਦੋ ਤੁਸੀਂ ਕਿਸ ਤਰ੍ਹਾਂ ਦੀਆਂ ਖਤਰਨਾਮਾ ਰਸਤਿਆਂ 'ਤੇ ਚਲਦੇ ਹੋਏ ਜਿੱਥੇ ਤੁਹਾਡੇ ਪੈਰ ਨੂੰ ਪੱਥਰ ਝਾੜੀ ਅਤੇ ਉਹ ਚੀਜ਼ਾਂ ਤੋਂ ਸੱਟ ਲੱਗ ਸਕਦੀ ਆ ਇਸ ਲਈ ਚੰਗੇ ਬੂਟਾਂ ਹਾਈਕਿੰਗ ਕਰਨ ਲਈ ਕਿਸ ਤਰ੍ਹਾਂ ਦੇ ਬੂਟ ਉਪਲਬਧ ਹਨ ਕੁਝ ਚੌੜੀ ਹਲਕੇ ਹੁੰਦੇ ਹਨ ਅਤੇ ਉਹਨਾਂ ਨੂੰ ਛੋਟੇ ਹਾਈਕਿੰਗ ਯਾਤਰਾ ਲਈ ਵਰਤੇ ਜਾਂਦੇ ਵਧੇ ਜਾ ਸਕਦੇ ਹੋ ਕੁਝ ਬੂਟ ਭਾਰੀ ਹੁੰਦੇ ਹਨ ਅਤੇ ਉਹਨਾਂ ਦੀ ਲੰਬਾਈ ਹਾਈਕਿੰਗ ਯਾਤਰਾ ਲਈ ਵਰਤੀ ਜਾ ਸਕਦੀ ਹੈ ਤੁਸੀਂ ਆਪਣੇ ਲੜੀ ਅਨੁਸਾਰ ਬੂਟਾਂ ਨੂੰ ਚੁਣ ਸਕਦੇ ਹੋ ਆਮ ਤਰ੍ਹਾਂ ਤਰਾਂ ਦੇ ਹਲਕੇ ਆਰਾਮਦਾਇਕ ਬੂਟ ਨੂੰ ਤਜ਼ਰਬੇ ਜਾਂਦੇ ਹਨ ਅਤੇ ਮੈਨੂੰ ਉਹ ਬੂਟ ਪਸੰਦ ਹਨ ਜੋ ਮੇਰੇ ਪੈਰਾਂ ਨੂੰ ਸੱਟ ਨਾ ਲੱਗਣ ਸੱਟ ਤੋਂ ਬਚਾਉਂਦੇ ਹਨ ਅਤੇ ਮੈਨੂੰ ਆਰਾਮਦਾਇਕ ਮਹਿਸੂਸ ਕਰਦੇ ਹਨ ਅਤੇ ਮੈਨੂੰ ਮੈਂ ਉਹ ਬੂਟ ਨੂੰ ਪਸੰਦ ਕਰਦਾ ਜੋ ਅਤੇ ਮੈਂ ਜੋ ਬਾਰਿਸ਼ ਤੋਂ ਬਚ ਕੇ ਹਾਈਕਿੰਗ ਕਰ ਸਕਦਾ ਹਾਂ ਜੇਕਰ ਪਹਿਲਾਂ ਵਾਰੀ ਹਾਈਕਿੰਗ ਕਰਨ ਅਤੇ ਹਾਂ ਤਾਂ ਮੈਨੂੰ ਆਪਣੇ ਫਰਸ਼ ਕਰਾਂ ਕਿ ਤੁਸੀਂ ਸਾਹ ਤੋਂ ਮਦਦ ਲੈ ਰਹੇ ਹੋ ਤੁਹਾਨੂੰ ਸਹੀ ਬੂਟ ਚੁਣਨ ਅਤੇ ਹਾਈਕਿੰਗ ਕਰਨ ਲਈ ਬਹੁਤ ਜ਼ਰੂਰੀ ਤਾਂ ਚੀਜ਼ ਦੀ ਚੁਣਨ ਵਿੱਚ ਮਦਦ ਕਰ ਸਕਦੇ ਹੋ ਧੰਨਵਾਦ